ਫੂਡ ਆਈਟਮਸ ਆਰ ਕੋਕੁਰਪੀਟਾ ਫਿਸੀਫੋਲੀਆ ਮਿਓਗੀਮੀਸੋ ਬ੍ਰੋਕੋਫਲਾਰ ਐਂਡ ਨੈਕਸਟ ਆਈਟਮ ਇਜ ਬਰਗਰ ਨੂਡਲਸ ਇਡਲੀ ਡੋਸਾ ਐਂਡ ਕੁਕੰਬਰ ਨਟਸ ਵੋਲਨਟਸ ਆਮੰਡ ਬਰੋਕੋਲੀ ਕੋਲੀਫਲਾਰ ਕੈਬੇਜ ਐਪਲ ਬਨਾਨਾ ਔਰੇਂਜ ਮੈਂਗੋ ਐਂਡ ਗਵਾਵਾ